ਮੈਂ ਰੋਪੜ ਸ਼ਹਿਰ ਤੋਂ ਬਿਲੌਂਗ ਕਰਦਾ ਹਾਂ ਅਤੇ ਇੱਥੇ ਤਕਰੀਬਨ ਕਾਫੀ ਸਾਰੀ ਲਾਇਬ੍ਰੇਰੀਆਂ ਹਨ ਅਤੇ ਪਹਿਲਾਂ ਤਾਂ ਮੈਂ ਆਪਣੇ ਪਿੰਡ ਤੋਂ ਹੀ ਸ਼ੁਰੂ ਕਰਦਾ ਹਾਂ ਸਾਡੇ ਪਿੰਡ ਪੰਚਾਇਤੀ ਜ਼ਮੀਨ ਦੇ ਵਿੱਚ ਇੱਕ ਕਾਫੀ ਵੱਡੀ ਲਾਇਬ੍ਰੇਰੀ ਬਣਾਈ ਹੋਈ ਹੈ ਅਤੇ ਦੂਜੀ ਲਾਇਬ੍ਰੇਰੀ ਤਕਰੀਬਨ ਰੋਪੜ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਕਾਲਜ ਦੇ ਸਾਹਮਣੇ ਬਣਾਈ ਗਈ ਹੈ ਅਤੇ ਤੀਜੀ ਲਾਇਬ੍ਰੇਰੀ ਆ ਜਿਹੜੀ ਸਟੇਡੀਅਮ ਦੇ ਬਿਲਕੁਲ ਲਾਗ ਹੀ ਬਣਾਈ ਗਈ ਹੈ ਅਤੇ ਤਕਰੀਬਨ ਮੈਂ ਜ਼ਿਆਦਾ ਕਰਕੇ ਤਿੰ ਜਾਂਦਾ ਰਹਿੰਦਾ ਹਾਂ ਲਾਇਬ੍ਰੇਰੀ ਅਤੇ ਜਦੋਂ ਮੈਂ ਜਾਂਦਾ ਹਾਂ ਉੱਥੇ ਦੇਖਦਾ ਹਾਂ ਕਿ ਉੱਥੇ ਹਰ ਪ੍ਰਕਾਰ ਦੀਆਂ ਪੁਸਤਕਾਂ ਹਰ ਲੈਂਗੁਏਜ਼ ਦੇ ਵਿੱਚ ਉੱਥੇ ਪਈਆਂ ਹੁੰਦੀਆਂ ਨੇ ਅਤੇ ਨੌਜਵਾਨਾਂ ਵਾਸਤੇ ਉੱਥੇ ਟੈਕਨੋਲਜੀ ਦੀਆਂ ਪੁਸਤਕਾਂ ਜਾਂ ਫਿਰ ਕੋਈ ਹੋਰ ਲੇਟੈਸਟ ਜਾਣਕਾਰੀ ਆਈ ਆ ਉਸ ਦੀਆਂ ਪੁਸਤਕਾਂ ਅਤੇ ਬਜ਼ੁਰਗਾਂ ਵਾਸਤੇ ਕੋਈ ਧਾਰਮਿਕ ਪੁਸਤਕਾਂ ਕਾਫੀ ਪੁਰਾਣੀ ਤੋਂ ਪੁਰਾਣੀ ਪੰਜਾਬ ਦੇ ਕਿੱਸੇ ਜਾਂ ਕਵਿਤਾਵਾਂ ਬਹੁਤ ਸਾਰੀਆਂ ਉੱਥੇ ਪੁਸਤਕਾਂ ਉਪਲਬਧ ਨੇ ਅਤੇ ਬੱਚਿਆਂ ਵਾਸਤੇ ਕਾਮੇਡੀ ਪੁਸਤਕਾਂ ਜਾਂ ਫਿਰ ਕੋਈ ਹੋਰ ਹਾਸੇ ਚੁਟਕਲੇ ਪੁਸਤਕਾਂ ਅਤੇ ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਜ਼ਿਆਦਾ ਬਹੁਤ ਵਧੀਆ ਲੱਗੀ ਉੱਥੇ ਕਿ ਉੱਥੇ ਰੋਜ਼ ਅਖ਼ਬਾਰ ਆਉਂਦਾ ਹੈ ਅਤੇ ਜਿਹੜਾ ਅਖ਼ਬਾਰ ਆਉਂਦਾ ਹੈ ਉਹ ਪੰਜਾਬੀ ਮਾਂ ਮੇਰੀ ਮਾਂ ਬੋਲੀ ਦੇ ਵਿੱਚ ਵੀ ਆਉਂਦਾ ਹੈ ਅਤੇ ਹਿੰਦੀ ਦੇ ਵਿੱਚ ਵੀ ਆਉਂਦਾ ਹੈ ਅਤੇ ਇ ਇੰਗਲਿਸ਼ ਦੇ ਵਿੱਚ ਵੀ ਆਉਂਦਾ ਹੈ ਅੰਗਰੇਜ਼ੀ ਅਤੇ ਮੈਂ ਜ਼ਿਆਦਾ ਕਰਕੇ ਅਜੀਤ ਅਖ਼ਬਾਰ ਪੜ੍ਹਦਾ ਹਾਂ ਕਿਉਂਕਿ ਇਹ ਮੇਰੀ ਮਾਂ ਬੋਲੀ ਦੇ ਵਿੱਚ ਹੈ ਅਤੇ ਇਸ ਦੇ ਵਿੱਚੋਂ ਮੈਂ ਕਾਫੀ ਸਾਰੀ ਜਾਣਕਾਰੀ ਪ੍ਰਾਪਤ ਕਰਦਾ ਹਾਂ ਅਤੇ ਜਿਵੇਂ ਕਿ ਰਿਸ਼ਤੇ ਵਗੈਰਾ ਜਾਂ ਫਿਰ ਜ਼ਮੀਨ ਦਾ ਕੋਈ ਕਿੱਥੇ ਕਿੰਨਾ ਵਿਕਾਊ ਹੈ ਜਾਂ ਫਿਰ ਕੋਈ ਹੋਰ ਜਾਣਕਾਰੀ ਹੈ ਪੰਜਾਬ ਵਿੱਚ ਕੀ ਚੱਲ ਰਿਹਾ ਹੈ ਅਤੇ ਕੀ ਨਹੀਂ ਚੱਲ ਰਿਹਾ ਅਤੇ ਮੌਸਮ ਦੇ ਬਾਰੇ ਸਾਨੂੰ ਦੱਸਦੇ ਰਹਿੰਦੇ ਨੇ ਅਤੇ ਜਦੋਂ ਮੈਂ ਹਰ ਐਤਵਾਰ ਨੂੰ ਵੈਸੇ ਤਾਂ ਰੋਪੜ ਦੇ ਵਿੱਚ ਜਿਹੜੀ ਇੱਕ ਸਰਕਾਰੀ ਕਾਲਜ ਦੇ ਸਾਹਮਣੇ ਉੱਥੇ ਜਾਂਦਾ ਹਾਂ ਪਰ ਜ਼ਿਆਦਾ ਕਰਕੇ ਮੈਂ ਆਪਣੇ ਡੇਲੀ ਜਿਹੜੀ ਪਿੰਡ ਦੀ ਜਗ੍ਹਾ ਪੰਚਾਇਤ ਦੇ ਵਿੱਚ ਬਣਾਈ ਗਈ ਹੈ ਲਾਇਬ੍ਰੇਰੀ ਉੱਥੇ ਜਾਂਦਾ ਰਹਿੰਦਾ ਹਾਂ ਜਿੱਥੇ ਕਿ ਸਾਡੇ ਪਿੰਡ ਦੇ ਬਜ਼ੁਰਗ ਆ ਜਿਹੜੇ ਉਹ ਬੈਠ ਕੇ ਕਿਤਾਬਾਂ ਪੜ੍ਹਦੇ ਹਨ ਅਤੇ ਅਖ਼ਬਾਰ ਪੜ੍ਹਦੇ ਹਨ